ਕਈ ਤਰ੍ਹਾਂ ਦੇ ਮੌਸਮ ਹੈ ਜੋ ਕਿ ਪੌਦਿਆਂ ਨੂੰ ਪ੍ਰਭਾਵਿਤ ਕਰਦੇ ਨੇ ਜਿਵੇਂ ਕਿ ਗਰਮੀ ਦਾ ਮੌਸਮ ਪੱਤਝੜ ਦਾ ਮੌਸਮ ਠੰਡ ਦਾ ਮੌਸਮ ਕਈ ਪੌਦੇ ਇਹੋ ਜਿਹੇ ਹਨ ਜਿਹੜੇ ਕਿ ਮੌਸਮ ਦੇ ਅਧਾਰਤ ਨਾਲ ਜਿਹੜਾ ਆਪਣਾ ਵਿਕਾਸ ਨਹੀਂ ਕਰ ਪਾਉਂਦੇ ਜਿਵੇਂ ਕਿ ਅੰਬਾਂ ਨੂੰ ਜਦੋਂ ਬੂਰ ਪੈਂਦਾ ਹੈ ਠੀਕ ਹੈ ਉਹ ਉਸਦੇ ਨਾਲ਼ ਜਿਹੜੇ ਹੈ ਅੰ ਪੌਦਿਆਂ ਦੀ ਜਿਹੜੀ ਵਿਕਾਸ ਹੈ ਉਦੋਂ ਰੁਕਦੀ ਹੈ ਇਸ ਲਈ ਆਪਾਂ ਖਾਦ ਜਿਹੜੀ ਨੈਚੁਰਲ ਖਾਦ ਹੈ ਉਹ ਇਸ ਤਰ੍ਹਾਂ ਵਰਤਦੇ ਹਾਂ ਕਿ ਪੌਦਿਆਂ ਦਾ ਜਿਹੜਾ ਵਿਕਾਸ ਹੈ ਉਹ ਸਹੀ ਢੰਗ ਨਾਲ ਹੁੰਦਾ ਰਹੇ ਅਤੇ ਪੌਦਿਆਂ ਨੂੰ ਮੌਸਮ ਤੋਂ ਬਚਾਇਆ ਜਾ ਸਕੇ ਬਹੁਤ ਜ਼ਿਆਦਾ ਜਿਹੜਾ ਪਾਣੀ ਹੈ ਬਹੁਤ ਜ਼ਿਆਦਾ ਪਾਣੀ ਦੀ ਮਾਤਰਾ ਵੀ ਪੌਦਿਆਂ ਨੂੰ ਖਰਾਬ ਕਰਦੀ ਹੈ ਇਸ ਲਈ ਪੌਦਿਆਂ ਦੇ ਆਲ਼ੇ ਦੁਆਲ਼ੇ ਸਾਨੂੰ ਇਸ ਤਰ੍ਹਾਂ ਦੀ ਜੋ ਜਿਵੇਂ ਕਿ ਇੱਟਾਂ ਦਾ ਜਿਹੜਾ ਘੇਰਾ ਬਣਾਉਣਾ ਚਾਹੀਦਾ ਜਿਸ ਦੇ ਨਾਲ ਜ਼ਿਆਦਾ ਪਾਣੀ ਹੈ ਪੌਦਿਆਂ 'ਚ ਜਮ੍ਹਾਂ ਨਾ ਹੋ ਸਕੇ ਪ੍ਰੋਪਰ ਜੋ ਜਿੰਨੀ ਅਮਾਊਂਟ ਸਾਨੂੰ ਪੌਦਿਆਂ ਨੂੰ ਚਾਹੀਦੀ ਹੈ ਜਿੰਨੀ ਮਾਤਰਾ 'ਚ ਪਾਣੀ ਚਾਹੀਦਾ ਉੱਨਾਂ ਹੀ ਪਾਣੀ ਅਸੀਂ ਉਸ ਦੇ ਵਿੱਚ ਪਾ ਸਕੀਏ ਇਸ ਤੋਂ ਬਿਨਾਂ ਅਸੀਂ ਸਪਰੇਅ ਰਹਿਤ ਜੋ ਖਾਦ ਹੈ ਉਹ ਵਰਤ ਸਕਦੇ ਹਾਂ ਜਿਸ ਦੇ ਨਾਲ਼ ਪੌਦਿਆਂ ਦਾ ਜਿਹੜਾ ਵਿਕਾਸ ਹੈ ਉਹ ਵਧੀਆ ਤਰੀਕੇ ਨਾਲ ਹੁੰਦਾ ਰਹੇ ਅਤੇ ਆਪਾਂ ਹੋਰ ਕਈ ਥਾਵਾਂ 'ਤੇ ਮਤਲਬ ਕਿ ਆਪਾਂ ਫੈਂਸਿੰਗ ਵਗੈਰਾ ਵਰਤ ਸਕਦੇ ਹਾਂ ਜਿਸ ਦੇ ਨਾਲ਼ ਸਾਡੇ ਜਿਹੜੇ ਪੌਦੇ ਹੈ ਪੇੜ ਪੌਦੇ ਹੈ ਉਹਨਾਂ ਦਾ ਵਿਕਾਸ ਵਧੀਆ ਤਰੀਕੇ ਨਾਲ਼ ਹੁੰਦਾ ਰਹੇ ਮੌਸਮਾਂ ਤੋਂ ਬਚਾਉਣ ਲਈ ਪੌਦਿਆਂ ਨੂੰ ਹੋਰ ਵੀ ਬ ਬਥੇਰੀਆਂ ਜੋ ਸਾਵਧਾਨੀਆਂ ਆਪਾਂ ਵਰਤ ਸਕਦੇ ਹਾਂ ਪਰ ਸਭ ਤੋਂ ਜ਼ਿਆਦਾ ਜਰੂਰੀ ਹੈ ਕਿ ਪੌਦਿਆਂ ਦੀ ਜੋ ਪੌਦੇ ਇਸ ਤਰ੍ਹਾਂ ਦੀ ਜਗ੍ਹਾ 'ਤੇ ਲਗਾਉਣੇ ਚਾਹੀਦੇ ਹਨ ਜਿੱਥੇ ਉਹ ਖੁੱਲ੍ਹੇ ਤਰੀਕੇ ਨਾਲ ਵੱਧ ਚੜ੍ਹ ਸਕਣ ਅਤੇ ਇਸ ਦੇ ਨਾਲ਼ ਹੀ ਪੌਦਿਆਂ ਦੀ ਸਾਂਭ ਸੰਭਾਲ ਹਮੇਸ਼ਾ ਵਧੀਆ ਤਰੀਕੇ ਨਾਲ ਕਰਨੀ ਚਾਹੀਦੀ ਹੈ ਉਹਨਾਂ ਨੂੰ ਗਰਮੀ ਦੇ ਮੌਸਮ ਵਿੱਚ ਵਾਰ ਵਾਰ ਜਿਹੜਾ ਹੈ ਪਾਣੀ ਦੀ ਮਾਤਰਾ ਉਹਨਾਂ ਨੂੰ ਪ੍ਰਦਾਨ ਕਰਨੀ ਚਾਹੀਦੀ ਹੈ ਕਿਉਂਕਿ ਸਾਨੂੰ ਪਤਾ ਹੈ ਜਿੰਨੀ ਵੀ ਸਾਡੀ ਜਿਹੜੀ ਬੋਡੀ ਨੂੰ ਆਕਸੀਜਨ ਹੈ ਉਹ ਪੌਦਿਆਂ ਦੁਆਰਾ ਹੀ ਮਿਲਣੀ ਹੈ ਜਿੰਨੀ ਵੀ ਸਾਨੂੰ ਸ਼ੁੱਧ ਹਵਾ ਹੈ ਉਹ ਸਾਨੂੰ ਪੌਦਿਆਂ ਦੁਆਰਾ ਮਿਲਣੀ ਹੈ